ਮੈਂ ਪੰਜਾਬ ਦੇ ਵਿੱਚ ਰਹਿੰਦੀ ਹੈ ਅਤੇ ਅੰਮ੍ਰਿਤਸਰ ਦੇ ਸਕੂਲ ਦੇ ਵਿੱਚ ਨੌਕਰੀ ਕਰਦੀ ਹੈ ਇਹ ਨੌਕਰੀ ਮੇਰੇ ਲਈ ਬਹੁਤ ਇੰਪੋਰਟੈਂਟ ਹੈ ਇਹ ਨੌਕਰੀ ਦੇ ਵਿੱਚ ਜਾਣ ਲਈ ਮੈਂ ਕਈ ਵਾਰ ਮੀਟਿੰਗਾਂ ਵੀ ਅਟੈਂਡ ਕੀਤੀ ਹੈ ਅਤੇ ਮੀਟਿੰਗਾਂ ਦੇ ਵਿੱਚ ਸ਼ਾਮਿਲ ਹੋਣ ਦੀ ਵੀਡੀਓ ਕਾਨਫਰੰਸ ਐਪ ਦੀ ਸੇਵਾ ਦੀ ਵਰਤੋਂ ਵੀ ਕੀਤੀ ਹੈ ਮੇਰਾ ਅਨੁਭਵ ਇਹ ਹੈ ਕਿ ਜਿਹੜੀ ਐਪ ਤੋਂ ਅਸੀਂ ਕਾਨਫਰੰਸ ਦੀ ਵਰਤੋਂ ਕਰਦੇ ਹੈ ਇਹ ਬਹੁਤ ਹੀ ਵਧੀਆ ਹੈ ਇਸਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਇਸ ਦੇ ਨਾਲ ਸਾਡਾ ਅਨੁਭਵ ਜਿਹੜਾ ਹੈ ਉਹ ਸਾਡਾ ਜੁੜ ਜਾਂਦਾ ਹੈ ਅਸੀਂ ਆਪਣਾ ਅਨੁਭਵ ਕਿਸੇ ਦੂਸਰੇ ਨੂੰ ਵੀ ਦੇ ਸਕਦੇ ਹਾਂ ਜਿਹੜਾ ਅਨੁਭਵ ਅਸੀਂ ਪ੍ਰਾਪਤ ਕਰਦੇ ਹਾਂ ਉਹ ਦੂਸਰਿਆਂ ਦੇ ਵਿੱਚ ਕਾਫੀ ਫਾਇਦੇਮੰਦ ਸਾਬਤ ਹੋ ਸਕਦੇ ਹੈ ਕਿ ਅਸੀਂ ਕੋਂਨਫਰੰਸ ਵਿੱਚ ਕਿੱਦਾਂ ਕਿਸੇ ਦੇ ਨਾਲ ਗੱਲ ਕੀਤੀ ਸਾਡਾ ਗੱਲ ਕਰਨ ਦਾ ਤਰੀਕਾ ਅਗਲੇ ਨਾਲ ਕੀ ਸੀ ਸਾਡੇ ਉੱਠਣ ਬੈਠਣ ਦਾ ਸਟਾਈਲ ਜਿੱਦਾਂ ਅਸੀਂ ਕਿਸੇ ਨਾਲ ਕੀ ਕਿਸ ਤਰ੍ਹਾਂ ਪੇਸ਼ ਆ ਸਕਦੇ ਹੈ ਇਸ ਤਰ੍ਹਾਂ ਦੀ ਵਰਤੋਂ ਉਹਨਾਂ ਨਾਲ ਬਹੁਤ ਜ਼ਿਆਦਾ ਕੀਤੀ ਜਾਂਦੀ ਇਸ ਕਰਕੇ ਇਸ ਐਪ ਦੀ ਅਸੀਂ ਜਿਹੜੀ ਸੇਵਾ ਦੀ ਵਰਤੋਂ ਕੀਤੀ ਹੈ ਉਸਦਾ ਅਨੁਭਵ ਬਹੁਤ ਹੀ ਵਧੀਆ ਹੈ ਸਾਨੂੰ ਇਸ ਐਪ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਕਿ ਦੂਜਿਆਂ ਨੂੰ ਵੀ ਇਸ ਐਪ ਦਾ ਇਸਤੇਮਾਲ ਕਰਨ ਦਾ ਵਧੀਆ ਮੌਕਾ ਮਿਲ ਸਕੇ ਅਸੀਂ ਮੀਟਿੰਗ ਵਿੱਚ ਸ਼ਾਮਿਲ ਹੋਣ ਦੇ ਨਾਲ ਇਸ ਵੀਡੀਓ ਕੋਂਨਫਰੈਂਸ ਜੇ ਦੂਸਰਿਆਂ ਨੂੰ ਦਿਖਾਵਾਂਗੇ ਉਹ ਵੀ ਇਹ ਇਹਦੇ ਤੋਂ ਕਾਫੀ ਪ੍ਰਭਾਵਿਤ ਹੋਣਗੇ ਕਿ ਇਸ ਐਪ ਦੇ ਵਿੱਚ ਜੁੜਨ ਦੇ ਨਾਲ ਸਾਨੂੰ ਹੋਰ ਵੀ ਕਾਫੀ ਜ਼ਿਆਦਾ ਅਨੁਭਵ ਵਧੀਆ ਪ੍ਰਾਪਤ ਹੋ ਸਕਦਾ ਅਸੀਂ ਉਸ ਐਪ ਦੇ ਨਾਲ ਅਸੀਂ ਵਧੀਆ ਤੋਂ ਵਧੀਆ ਆਪਣੀ ਕਿਸੇ ਦੇ ਨਾਲ ਅਨੁਭਵ ਪ੍ਰਾਪਤ ਕਰ ਸਕਦੇ ਅਤੇ ਆਪਣਾ ਅਨੁਭਵ ਵੀ ਬਹੁਤ ਵਧੀਆ ਦੇ ਸਕਦੇ ਹਾਂ ਉਹਨਾਂ ਨੂੰ ਜਿਹੜੇ ਸਾਡੇ ਵੀਡੀਓ ਕੋਂਨਫਰੰਸ ਦੇ ਵਿੱਚ ਅਸੀਂ ਐਪ ਦੇ ਵਿੱਚ ਨਾਲ ਬਣਾਈ ਹੈ ਉਹ ਅਸੀਂ ਕਿਸੇ ਦੂਜੇ ਨੂੰ ਦਿਖਾਵਾਂਗੇ ਤਾਂ ਉਹ ਵੀ ਉਹ ਹੀ ਅਨੁਭਵ ਪ੍ਰਾਪਤ ਕਰ ਸਕਦਾ ਜਿਹੜਾ ਕਿ ਅਸੀਂ ਵਧੀਆ ਵਧੀਆ ਅਨੁਭਵ ਉਹ ਦੂਜੇ ਰਾਹੀਂ ਪ੍ਰਾਪਤ ਕੀਤਾ ਹੁੰਦਾ ਹੈ ਇਸ ਕਰਕੇ ਜਿਹੜਾ ਸਾਡਾ ਅਨੁਭਵ ਹੈ ਉਹ ਜਿਹੜਾ ਕਾਨਫਰੰਸਿੰਗ ਐਪ ਦੇ ਜਿਸ ਦੀ ਅਸੀਂ ਵਰਤੋਂ ਕੀਤੀ ਹੈ ਉਸਦੇ ਨਾਲ ਦੂਜਿਆਂ ਤੋਂ ਬਹੁਤ ਪ੍ਰਭਾਵਿਤ ਹੋ ਸਕਦਾ ਇਸ ਕਰਕੇ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਮੈਂ ਇਹੀ ਕਹਾਂਗੀ ਕਿ ਇਹ ਐਪ ਦੀ ਸੇਵਾ ਜ਼ਰੂਰ ਕੀਤੀ ਜਾ ਸਕਦੀ ਹੈ